ਹੈਲੋ ਸਤਿ ਸ਼੍ਰੀ ਅਕਾਲ ਸਰ ਆਪ ਜੀ ਛਾਬੜਾ ਫੋਟੋਗ੍ਰਾਫੀ ਤੋਂ ਜੀ ਬੋਲ ਰਹੇ ਹੋ ਜੀ ਹਾਂਜੀ ਮੈਨੂੰ ਨਾ ਜੀ ਇੱਕ ਤਾਂ ਪਾਸਪੋਰਟ ਸਾਈਜ਼ ਫੋਟੋ ਚਾਹੀਦੀਆਂ ਸੀ

ਹਾਂਜੀ ਮੈਂ ਫੋਟੋਆਂ ਫਿਰ ਤੁਸੀਂ ਦੱਸੋ ਨਾ ਫਿਰ ਉਸ ਹਿਸਾਬ 'ਤੇ ਜਿੰਨੇ ਪੈਸੇ ਲੱਗ ਜਾਣਗੇ ਕਿਉਂਕਿ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਅਤੇ ਬੱਤੀ ਫੋਟੋਆਂ ਸੌ 'ਚ ਅਤੇ ਅੱਠ ਪੰਜਾਹ 'ਚ ਇਹ ਕੀ ਹੈ ਅੱਛਾ ਅੱਛਾ

ਅਤੇ ਫਿਰ ਮਤਲਬ ਫਾਇਦਾ ਕਿੰਨੇ 'ਚ ਰਹੁਗਾ ਜੀ ਬੱਤੀ ਜੀ ਏਟ ਇਹ ਫਿਰ ਕਿਵੇਂ ਮਤਲਬ ਹੋਊਗਾ ਬਲੈਕ ਐਂਡ ਵਾਈਟ ਹੋਣਗੇ ਜਾਂ ਕਲਰ ਹੋਣਗੀਆਂ ਕਿੱਦਾਂ ਕੁੱਲ ਕਲਰ ਕਿੰਨੇ ਮੈਗਾਪਿਕਸਲ ਮਤਲਬ ਕਿਹੜੇ ਪਿਕਸਲ ਵਗੈਰਾ ਕਿਵੇਂ ਵਧੀਆ ਹੋਣਗੇ ਕੁਆਲਿਟੀ ਕਉਲਿਟੀ ਮਤਲਬ ਵਧੀਆ ਹੋਵੇਗੀ ਸਾਰੇ ਤਰਫ ਚੱਲ ਜਾਵੇਗੀ ਮਤਲਬ ਜਿਵੇਂ ਆਪਾਂ ਸਕੈਨ ਕਰਾਉਂਦੇ ਆ ਫੋਟੋ ਕਈ ਵਾਰੀ ਆਉਂਦੀ ਨਹੀਂ ਨਾ ਨਹੀਂ ਨਹੀਂ ਕਈ ਵਾਰ ਫਿਰ ਉਹ ਚੱਕਦੇ ਨਹੀਂ ਨਾ ਉਸ ਤਰੀਕੇ ਫੋਟੋ ਕਈ ਵਾਰ ਬੈਕਗਰਾਊਡ ਉਂਝ ਹੁੰਦਾ ਤੇ ਫਿਰ ਉਸ ਤਰੀਕੇ ਮੈਨੂੰ ਕੁਆਲਿਟੀ ਵੀ ਚਾਹੀਦੀ ਹੈ ਨਹੀਂ ਸਪੈਸ਼ਲ ਨਹੀਂ ਬਸ ਸਿੰਪਲ ਚਾਹੀਦਾ ਵੀ ਉਹ ਪਿਕਸਲ ਵਗੈਰਾ ਜ਼ਿਆਦਾ ਜਿਵੇਂ ਖ਼ਰਾਬ ਨਾ ਹੋਣ ਜਾਂ ਕੋਈ ਸਕੈਨ ਹੋ ਜਾਵੇ ਬਸ ਹਾਂਜੀ ਹਾਂਜੀ ਠੀਕ ਹੈ ਨਹੀਂ ਮੈਨੂੰ ਤਾਂ ਫਿਰ ਓਨ ਦਾ ਸਪੋਰਟ ਚਾਹੀਦਾ ਜ਼ਰੂਰੀ ਚਾਹੀਦਾ ਥੋੜ੍ਹਾ ਜਿਹਾ ਜਲਦੀ ਹਾਂਜੀ ਹਾਂਜੀ ਹਾਂਜੀ ਨਹੀਂ ਤੁਸੀਂ ਫੁੱਲ ਹੀ ਕਰ ਦਿਓ ਫਿਰ ਹਾਂਜੀ ਹਾਂਜੀ ਬੱਤੀ ਫੋਟੋਆਂ ਕਰ ਦਿਓ ਅਤੇ ਮੈਂ ਫਿਰ ਤੁਹਾਡੇ ਕੋਲ ਆਉਣਾ ਪੈਣਾ ਮੈਨੂੰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਨਹੀਂ ਨਹੀਂ ਉੱਥੇ ਮੈਂ ਕੈਸ਼ ਦੇ ਦੂੰਗਾ ਉਹ ਅਤੇ ਉਹ ਫਿਰ ਤੁਸੀਂ ਮੈਨੂੰ ਓਨ ਦਾ ਸਪੋਰਟ ਜਿਵੇਂ ਨਾਲ ਦੇ ਨਾਲ ਦੇ ਹੀ ਦਿਓਗੇ ਨਹੀਂ ਨਹੀਂ ਤੁਸੀਂ ਦੱਸੋ ਥੋੜ੍ਹਾ ਜਿਹਾ ਮੈਨੂੰ ਹਾਂਜੀ ਹਾਂਜੀ ਕੋਈ ਨਾ ਓਕੇ ਹਾਂਜੀ ਹਾਂਜੀ ਆਕੇ ਆਕੇ ਹਾਂਜੀ ਹਾਂਜੀ ਓਕੇ ਓਕੇ ਥੈਂਕ ਯੂ ਜੀ ਓਕੇ